ਪੰਜਾਬੀ ਭਾਸ਼ਾ ਨੂੰ ਜਿਵੇਂ ਕਿ ਸੰਸਕ੍ਰਿਤੀ ਹੋ ਗਿਆ ਜਾਂ ਅੰਗਰੇਜ਼ੀ ਹੋ ਗਈ ਜਾਂ ਹਿੰਦੀ ਹੋਈ ਆ ਇਹਨੇ ਕਾਫ਼ੀ ਵੈਸੇ ਪ੍ਰਭਾਵਿਤ ਕੀਤਾ ਹੈ ਅੱਜ ਆਉਣ ਵਾਲੇ ਟਾਇਮ ਦੇ ਵਿੱਚ ਅਤੇ ਪ੍ਰਭਾਵਿਤ ਕਰ ਵੀ ਰਹੀ ਹੈ ਕਿਉਂਕਿ ਜਿਹੜੇ ਅੱਜ ਕੱਲ੍ਹ ਦੇ ਬੱਚੇ ਆ ਨਾ ਮੋਸਟਲੀ ਸ਼ਹਿਰਾਂ ਦੇ ਵਿੱਚ ਉਹ ਹਿੰਦੀ ਬੋਲਦੇ ਨੇ ਅਤੇ ਅਤੇ ਜਦੋਂ ਆਪਾਂ ਸਕੂਲ ਦੇ ਵਿੱਚ ਜਾਈਏ ਤਾਂ ਜ਼ਿਆਦਾ ਟੀਚਰ ਇਹਨਾਂ ਨੂੰ ਕਹਿ ਦਿੰਦੇ ਵੀ ਤੁਸੀਂ ਅੰਗਰੇਜ਼ੀ ਦੇ ਵਿੱਚ ਗੱਲ ਕਰੋ ਪਰ ਮੈਨੂੰ ਨਹੀਂ ਲੱਗਦਾ ਪੰਜਾਬੀ ਵੀ ਆਪਣੀ ਮਾਂ ਬੋਲੀ ਆ ਇਹਨੂੰ ਨਹੀਂ ਭੁੱਲਣਾ ਚਾਹੀਦਾ ਅਤੇ ਮੈਂ ਜ਼ਿਆਦਾ ਕਰਕੇ ਮੋਸਟਲੀ ਪੰਜਾਬੀ ਦੇ ਵਿੱਚ ਹੀ ਗੱਲ ਕਰਦਾ ਹਾਂ